ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਭਾਰਤ ਸਰਕਾਰ ਨੇ ਉਹਨਾਂ ਦੇ ਉਭਰਦੇ ਹੋਏ ਸਰੋਤਿਆਂ ਲਈ ਬਹੁਤ ਸਾਰੇ ਰੋਜ਼ਗਾਰਾਂ ਦਾ ਪ੍ਰਬੰਧ ਕੀਤਾ ਹੈ ਅਤੇ ਉਹਨਾਂ ਨੂੰ ਵਿੱਦਿਆ ਪ੍ਰਦਾਨ ਕਰਨ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਹਨ ਜਿੱਦਾਂ ਅਸੀਂ ਦੇਖਦੇ ਹਾਂ ਕਿ ਲੋਕ ਢਾਬੇ ਜਾਂ ਖੇਤਾਂ ਵਿੱਚ ਕੰਮ ਕਰਦੇ ਹਨ ਪਰ ਉਹਨਾਂ ਲਈ ਅੱਜ ਕੱਲ੍ਹ ਰੋਜ਼ਗਾਰ ਦਾ ਪ੍ਰੋਗਰਾਮ ਚਾਲੂ ਕੀਤਾ ਹੈ ਜਿਹਦੇ ਵਿੱਚ ਉਹ ਆਪਣੀਆਂ ਖੁਦ ਦੀਆਂ ਇੰਡਸਟਰੀਆਂ ਖੋਲ੍ਹ ਸਕਦੇ ਹਾਂ ਜਿੱਦਾਂ ਕਿ ਕਈ ਲੋਕਾਂ ਨੂੰ ਹੈਂਡੀਕ੍ਰਾਫਟ ਆਉਂਦਾ ਹੁੰਦਾ ਹੈ ਅਤੇ ਉਹ ਆਪਣੇ ਘਰ ਹੀ ਮਸ਼ੀਨ ਲਗਾ ਕੇ ਆਪਣਾ ਕੰਮ ਕਰ ਸਕਦੇ ਹਨ ਅੱਜ ਕੱਲ੍ਹ ਲੋਕਾਂ ਲਈ ਉਹਨਾਂ ਨੇ ਗਰੀਬ ਲੋਕਾਂ ਲਈ ਉਹਨਾਂ ਨੇ ਕੈਂਡਲ ਬਣਾਉਣ ਵਾਲੇ ਕੰਮ ਜਾਂ ਫਿਰ ਫਾਰਮਰ ਵਗੈਰਾ ਲਈ ਵੀ ਉਹਨਾਂ ਨੇ ਨਵੇਂ ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਹਨ ਜਿਹਦੇ ਵਿੱਚ ਉਹਨਾਂ ਨੂੰ ਪੜ੍ਹਾਈ ਦਾ ਵੀ ਪ੍ਰੋਗਰਾਮ ਚਾਲੂ ਕੀਤਾ ਹੈ ਅਤੇ ਉਹਨਾਂ ਨੂੰ ਨਵੇਂ ਘਰ ਵੀ ਦਿੱਤੇ ਹਨ ਜਿਹਦੇ ਨਾਲ ਰੋਜ਼ਗਾਰ ਵੱਧ ਰਿਹਾ ਹੈ ਅਤੇ ਲੋਕ ਥੋੜ੍ਹੇ ਅਮੀਰ ਹੋ ਰਹੇ ਹਨ ਅਤੇ ਹੁਣ ਪੋਵਰਟੀ ਰੇਟ ਵੀ ਇੰਡੀਆ ਦਾ ਬਹੁਤ ਘੱਟ ਰਿਹਾ ਹੈ ਜਿਹਦੇ ਕਰਕੇ ਇੰਡੀਆ ਬਹੁਤ ਅੱਗੇ ਤਰੱਕੀ ਕਰ ਰਿਹਾ ਹੈ ਅਤੇ ਸਰਕਾਰ ਨੇ ਬਹੁਤ ਸਾਰੇ ਕਾਰੋਬਾਰ ਹੋਰ ਵੀ ਚਾਲੂ ਕੀਤੇ ਹਨ ਜਿੱਦਾਂ ਕਿ ਉਹਨਾਂ ਨੂੰ ਘਰ ਬੈਠੇ ਹੀ ਕੰਮ ਦਿੱਤਾ ਜਾ ਰਿਹਾ ਹੈ ਜਿਹੜੇ ਥੋੜ੍ਹੇ ਬੱਚੇ ਹਨ ਉਹਨਾਂ ਲਈ ਸਕੂਲ ਤੋਂ ਬਾਅਦ ਵੀ ਕੰਮ ਕਰਨ ਦਾ ਤਰੀਕਾ ਦੱਸਿਆ ਜਾ ਰਿਹਾ ਹੈ ਜਿੱਦਾਂ ਕਿ ਬੋਟਲਸ ਵਗੈਰਾ ਰੀਸਾਈਕਲ ਕਰਨ ਦੇ ਵੀ ਪਲਾਂਟ ਲਗਾਏ ਗਏ ਹਨ ਅਤੇ ਕੰਪਨੀਆਂ ਬੋਟਲਸ ਇਕੱਠੀਆਂ ਕਰਕੇ ਫਿਰ ਉਹਨਾਂ ਨੂੰ ਰੀਸਾਈਕਲ ਕਰਕੇ ਚੀਜ਼ਾਂ ਬਣਾਉਂਦੀਆਂ ਹਨ ਜਿਹਦੇ ਵਿੱਚ ਇੱਕ ਤਾਂ ਪੋਲਿਊਸ਼ਨ ਘੱਟ ਹੁੰਦੀ ਹੈ ਅਤੇ ਦੂਜਾ ਪਲਾਸਟਿਕ ਵੇਸਟ ਵੀ ਯੂਜ ਹੁੰਦਾ ਹੈ ਜਿਹਦੇ ਨਾਲ ਸਾਰਾ ਕੁਛ ਵਧੀਆ ਹੋ ਰਿਹਾ ਹੈ ਅਤੇ ਇੰਡੀਆ ਬਹੁਤ ਜ਼ਿਆਦਾ ਤਰੱਕੀ ਕਰ ਰਿਹਾ ਹੈ